ਮੈਂ ਗੈਸ ਏਜੰਸੀ ਨੂੰ ਕੋਲ ਕੀਤੀ ਇਹ ਭਾਰਤ ਗੈਸ ਏਜੰਸੀ ਬੋਲ ਰਹੀ ਹੈ ਮੇਰੀ ਇੱਕ ਬੁਕਿੰਗ ਸੀ ਸਿਲੰਡਰ ਦੀ ਜੋ ਕਿ ਮੇਰੀ ਬੁਕਿੰਗ ਆਈਡੀ ਚੌਰਾਸੀ ਤੇਤੀ ਇਕਤਾਲੀ ਬਿਆਲੀ ਤਰਤਾਲੀ ਪੰਤਾਲੀ ਛਿਆਲੀ 'ਤੇ ਰਜਿਸਟਰ ਹੈ ਅਤੇ ਮੇਰੇ ਆਧਾਰ ਕਾਰਡ ਦੇ ਪਿਛਲੇ ਦੋ ਅੰਕ ਹਨ ਅਠਾਸੀ ਬਾਨਵੇਂ ਅਤੇ ਕਿਰਪਾ ਕਰਕੇ ਮੈਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ ਕਿ ਮੇਰੀ ਬੁਕਿੰਗ ਦੀ ਕੀ ਸਥਿਤੀ ਹੈ ਅਤੇ ਇਹ ਕਦੋਂ ਤੱਕ ਮੈਨੂੰ ਮਿਲ ਜਾਵੇਗਾ